ਵੈਸੇ ਤਾਂ ਮੈਨੂੰ ਮੂਰਤੀਆਂ ਬਣਾਉਣ ਦਾ ਐਨਾ ਕੋਈ ਸ਼ੌਕ ਨਹੀਂ ਹੈ ਕਿਉਂਕਿ ਸਾਡੇ ਜਿਹੜੇ ਪਹਿਲੇ ਗੁਰੂ ਹੋਏ ਸਨ ਸਿੱਖ ਧਰਮ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਵੀ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ ਅਤੇ ਸਾਨੂੰ ਮੂਰਤੀਆਂ ਨਹੀਂ ਬਣਾਉਣੀਆਂ ਚਾਹੀਦੀਆਂ ਪਰ ਫੇਰ ਵੀ ਸ਼ੌਕੀਆ ਤੌਰ 'ਤੇ ਮੈਂ ਇੱਕ ਵਾਰੀ ਮੂਰਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਮੂਰਤੀ ਸੀ ਗਨੇਸ਼ ਜੀ ਦੀ ਅਤੇ ਗਨੇਸ਼ ਜੀ ਦੀ ਜਦੋਂ ਮੈਂ ਮੂਰਤੀ ਬਣਾਈ ਅਤੇ ਉਹ ਮੈਂ ਸਿੱਖੀ ਸੀ ਯੂਟੀਊਬ ਤੋਂ ਯੂਟੀਊਬ ਤੋਂ ਜਦੋਂ ਮੈਂ ਮੂਰਤੀ ਬਣਾਉਣਾ ਸਿੱਖਿਆ ਤਾਂ ਉਹਨਾਂ ਨੇ ਜਿੱਦਾਂ ਜਿੱਦਾਂ ਸਟੈਪ ਦੱਸੇ ਸੀ ਮੈਂ ਉਹਨਾਂ ਨੂੰ ਫੋਲੋ ਕਰਦੀ ਗਈ ਪਹਿਲੇ ਮੈਂ ਇੱਕ ਬਜ਼ਾਰੋਂ ਮਿੱਟੀ ਲੈ ਕੇ ਆਈ ਸੁੱਕੀ ਅਤੇ ਫੇਰ ਉਹ ਗਿੱਲੀ ਕਰਕੇ ਅਤੇ ਉਹਨੂੰ ਗਨੇਸ਼ ਜੀ ਦੀ ਸ਼ੇਪ ਦਿੱਤੀ ਅਤੇ ਫਿਰ ਮੈਂ ਉਹਨੂੰ ਦੋ ਤਿੰਨ ਦਿਨ ਧੁੱਪ ਵਿੱਚ ਸੁੱਕਣ ਵਾਸਤੇ ਰੱਖ ਦਿੱਤੀ ਤਾਂ ਕਿ ਜਿਹੜੀ ਮਿੱਟੀ ਸੀ ਉਹ ਪੂਰੀ ਤਰ੍ਹਾਂ ਸੁੱਕ ਜੇ ਅਤੇ ਉਸ ਤੋਂ ਬਾਅਦ ਮੈਂ ਉਹਦੇ ਉੱਤੇ ਕਲਰ ਕੀਤੇ ਮੂਰਤੀ 'ਤੇ ਜਿਹੜੇ ਪੇਂਟਿੰਗ ਕਲਰ ਹੁੰਦੇ ਸਨ ਅਤੇ ਉਹ ਕਾਫੀ ਅੱਛੀ ਲੱਗ ਰਹੀ ਸੀ ਅਤੇ ਜਦੋਂ ਕਲਰ ਕਰਨ ਤੋਂ ਬਾਅਦ ਮੂਰਤੀ ਪੂਰੀ ਤਰ੍ਹਾਂ ਸੁੱਕ ਗਈ ਅਤੇ ਅਸੀਂ ਉਹਨੂੰ ਆਪਣੇ ਸੁੱਚੀ ਕਰਕੇ ਅਤੇ ਜਿਹੜਾ ਸਾਡਾ ਮੰਦਰ ਹੈ ਰੋਜ਼ ਜਿੱਥੇ ਅਸੀਂ ਧੂਫ ਬੱਤੀ ਕਰਦੇ ਹਾਂ ਅਤੇ ਉੱਥੇ ਅਸੀਂ ਉਹਨੂੰ ਬਿਰਾਜਮਾਨ ਕਰ ਦਿੱਤਾ